ਭਾਰਤ ਵਿੱਚ ਸੇਵਾ ਸੰਭਾਲ ਸਿਹਤ ਸੰਭਾਲ ਪ੍ਰਣਾਲੀ ਦੋ ਤਰ੍ਹਾਂ ਦੀ ਹੈ ਇੱਕ ਤਾਂ ਸਰਕਾਰੀ ਹੈ ਇੱਕ ਪ੍ਰਾਈਵੇਟ ਜਿਹੜੀ ਸਰਕਾਰੀ ਹੈ ਉਹ ਤਾਂ ਡਿਊਟੀ ਦੇ ਹਿਸਾਬ ਨਾਲ ਹੀ ਚੱਲਦੀ ਹੈ ਅਤੇ ਜਿਹੜਾ ਪੇਮੈਂਟ ਹੈ ਸਟਾਫ ਅਤੇ ਡਾਕਟਰਾਂ ਦੀ ਉਹ ਗੌਰਮੈਂਟ ਕਰਦੀ ਹੈ ਤਾਂ ਕਰਕੇ ਇੱਕ ਸਰਕਾਰੀ ਹਸਪਤਾਲ ਵਾਸਤੇ ਉਸ ਜਗ੍ਹਾ ਦੀ ਜਿਹੜੀ ਸਰਕਾਰ ਹੈ ਉਸ ਸਟੇਟ ਦੀ ਸਰਕਾਰ ਉਸ 'ਤੇ ਬਹੁਤ ਡਿਪੈਂਡ ਪ ਕਰਦਾ ਕਿ ਉਹ ਸਿਹਤ ਵਾਲੇ ਪਾਸੇ ਕਿੰਨਾ ਬਜਟ ਦੇ ਰਹੀ ਹੈ ਨਹੀਂ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਡਾਕਟਰਾਂ ਦੀ ਕਮੀ ਹੈ ਸਟਾਫ ਦੀ ਕਮੀ ਹੈ ਬਾਕੀ ਲੈਬ ਲੈਬਾਂ 'ਚ ਜਿਹੜੇ ਟੈਸਟ ਹੁੰਦੇ ਨੇ ਉਹ ਮਸ਼ੀਨਰੀ ਦੀ ਕਮੀ ਹੈ ਜਿਹੜੀ ਟੈਕਨੋਲਜੀ ਹੈ ਉਹ ਪੂਰੀ ਨਹੀਂ ਹੈਗੀ ਪਰ ਜਿੱਥੇ ਲੋਕ ਪ੍ਰਾਈਵੇਟ ਇਲਾਜ ਕਰਵਾਉਣਾ ਚਾਹੁੰਦੇ ਨੇ ਉਹ ਪ੍ਰਣਾਲੀ ਬਹੁਤ ਵਧੀਆ ਪਰ ਉਹ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਹੈਗਾ ਕਿਉਂਕਿ ਪ੍ਰਾਈਵੇਟ ਦੇ ਵਿੱਚ ਅੱਜ ਕੱਲ੍ਹ ਖਰਚੇ ਬਹੁਤ ਜ਼ਿਆਦਾ ਨੇ ਅਤੇ ਹਰ ਬੰਦਾ ਪ੍ਰਾਈਵੇਟ ਤੌਰ 'ਤੇ ਇਲਾਜ ਵੀ ਨਹੀਂ ਕਰਵਾ ਸਕਦਾ ਜਿੱਥੇ ਸਰਕਾਰੀ ਦੇ ਦੇ ਵਿੱਚ ਉਹ ਇਲਾਜ ਫਰੀ ਹੈ ਪ੍ਰਾਈਵੇਟ ਦੇ ਵਿੱਚ ਉੱਥੇ ਹੀ ਕਾਫੀ ਹਜ਼ਾਰਾਂ ਅਤੇ ਲੱਖਾਂ ਰੁਪਏ ਲੱਗ ਜਾਂਦੇ ਹਨ ਇਸ ਕਰਕੇ ਜੇ ਸਰਕਾਰ ਚਾਹੇ ਤਾਂ

ਉੱਥੇ ਪ੍ਰੋਪਰ ਸਟਾਫ ਦਵਾਈਆਂ ਅਤੇ ਡਾਕਟਰਾਂ ਦੀ ਸੇਵਾ ਲੈ ਸਕਦੀ ਹੈ ਜਿੱਥੇ ਕਿ ਲੋਕਾਂ ਨੂੰ ਸਹੂਲਤ ਵੀ ਹੋਵੇਗੀ ਅਤੇ ਮੈਂ ਕਹਿਣਾ ਚਾਹੂੰਗਾ ਕਿ ਜਿਹੜੀ ਇੱਕ ਵਿੱਦਿਆ ਅਤੇ ਇੱਕ ਸਿਹਤ ਇਹ ਦੋ ਚੀਜ਼ਾਂ ਇਹੋ ਜਿਹੀਆਂ ਨੇ ਜਿਸ ਤੋਂ ਸਰਕਾਰ ਨੂੰ ਭੱਜਣਾ ਨਹੀਂ ਚਾਹੀਦਾ ਕਿਉਂਕਿ ਸਰਕਾਰ ਹੈ ਜਿਹੜੀ ਉਹ ਜਿੰਨਾ ਜ਼ਿਆਦਾ ਸਿਹਤ 'ਤੇ ਸ਼ਿਖਸ਼ਾ ਦੇ ਪੈਸੇ ਲਾਉਗੀ ਉਹਦੇ ਨਾਲ ਕੀ ਹੈ ਕਿ ਓਨਾ ਹੀ ਜਿਹੜਾ ਆਉਣ ਵਾਲੇ ਟਾਈਮ 'ਚ ਲੋਕਾਂ ਨੂੰ ਵੀ ਫਾਇਦਾ ਹੈ ਅਤੇ ਸਰਕਾਰ ਨੂੰ ਵੀ ਫਾਇਦਾ ਹੈ